ਪਾਣੀ ਤਾਂ ਇੱਕ ਬੜਾ ਬਹੁਮੁੱਲ ਪ੍ਰੋਟੀਨ ਹੈ ਸਰੀਰ ਦੇ ਵਾਸਤੇ ਜਿਹੜਾ ਕਿ ਸਾਨੂੰ ਸਾਡੇ ਸਰੀਰ ਨੂੰ ਫਿਟ ਰੱਖਣ ਵਿੱਚ ਸਹਾਇਤਾ ਕਰਦਾ ਬਚਪਨ ਵਿੱਚ ਤਾਂ ਪਾਣੀ ਤਾਂ ਸਾਡੀ ਜਾਨ ਹੁੰਦੀ ਸੀ ਬਚਪਨ 'ਚ ਕੋਈ ਟਾਈਮ ਨਹੀਂ ਰੋਟੀ ਮਿਲੇ ਨਾ ਮਿਲੇ ਪਾਣੀ ਦੀ ਬੋਤਲ ਪੀ ਲਓ ਠੰਡੀ ਮਾਵਾਂ ਨੇ ਮਾਰਨਾ ਵੀ ਭਰਾਵਾਂ ਨੇ ਮਾਰਨਾ ਵੀ ਤੂੰ ਪਾਣੀ ਪੀਈ ਜਾਂਦਾ ਕੁੱਤਿਆ ਤੈਨੂੰ ਰੋਟੀ ਨਹੀਂ ਦਿੰਦੇ ਤੂੰ ਰੋਟੀ ਨਹੀਂ ਖਾਂਦਾ ਤੇਰਾ ਢਿੱਡ ਪਾਣੀ ਨਾਲ ਭਰ ਜਾਣਾ ਮਰਨਾ ਕੁੱਤਿਆ ਤੂੰ ਰੋਟੀ ਖਾਇਆ ਕਰ ਪਾਣੀ ਪੀਈ ਜਾਂਦਾ ਪਾਣੀ ਪੀਈ ਜਾਂਦਾ ਮਾਰ ਵੀ ਖਾਂਦੇ ਖਾਣੀ ਖਾਣੀ ਪੈਂਦੀ ਹੈ ਕਈ ਵਾਰ ਠੀਕ ਆ ਪਾਣੀ ਪੀਣਾ ਦਿਨ ਵਿੱਚ ਵੀ ਰਾਤ ਨੂੰ ਤਾਂ ਜੰਗ ਏਜ਼ ਦੇ ਵਿੱਚ ਤਾਂ ਕੋਈ ਪਾਣੀ ਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਹੈਗਾ ਨਾ ਜਦੋਂ ਦਿਲ ਕਰਦਾ ਪੀਓ ਪੀਣਾ ਵੀ ਚਾਹੀਦਾ ਜੇ ਫਿਟ ਹੁੰਦਾ ਤਾਂ ਬੁਢਾਪੇ 'ਚ ਲੋਕ ਸੋਚਦੇ ਹੈ ਕਿ ਇਸ ਵੇਲੇ ਪਾਣੀ ਜ਼ਿਆਦਾ ਪੀਓ ਇਸ ਵੇਲੇ ਘੱਟ ਪੀਓ ਕਿਲੋ ਪੀਓ ਦੋ ਕਿਲੋ ਪੀਓ ਚਾਰ ਕਿਲੋ ਪੀਓ ਪਰ ਕੁੱਲ ਮਿਲਾ ਕੇ ਉਮਰ ਉਮਰ ਦਾ ਲਿਹਾਜ ਨਾਲ ਪਾਣੀ ਦੀ ਮੰਗ ਅਲੱਗ ਅਲੱਗ ਹੈ ਪਰ ਮੇਰੇ ਹਿਸਾਬ ਨਾਲ ਇਹ ਹੈ ਕਿ ਪਾਣੀ ਭੁੱਖੇ ਢਿੱਡ ਨਹੀਂ ਪੀਣਾ ਚਾਹੀਦਾ ਜ਼ਿਆਦਾ ਬਚਪਨ ਲਈ ਖ਼ਾਸ ਕਰਕੇ ਔਰ ਉਸਤੋਂ ਪਹਿਲਾਂ ਕੁਛ ਨਾ ਕੁਛ ਖਾ ਲੈਣਾ ਚਾਹੀਦਾ ਦਿਨ ਦੇ ਵਿੱਚ ਬੁੱਢੇ ਬੰਦਿਆਂ ਨੂੰ ਠੰਡ 'ਚ ਵੀ ਪਾਣੀ ਪੀਣਾ ਚਾਹੀਦਾ ਪਾਣੀ ਪੀਓ ਘੱਟ ਖਾਓ ਜ਼ਿਆਦਾ ਖਾਣ ਦਾ ਮਤਲਬ ਹੈ ਕਿ ਥੋੜ੍ਹਾ ਥੋੜ੍ਹਾ ਕਰਕੇ ਇੱਕ ਇੱਕ ਘੁੱਟ ਦੋ ਦੋ ਘੁੱਟ ਪੀਓ ਆਹਿਸਤਾ ਆਹਿਸਤਾ ਅੰਦਰ ਜਾਣ ਦਿਓ ਜਿੱਦਾਂ ਕਿਤੇ ਮੀਂਹ ਸਲੋਅ ਮੀਂਹ ਪੈਂਦਾ ਨਾ ਸਲੋਅ ਮੀਂਹ ਪਵੇ ਕਿੰਨਾ ਸਾਰੇ ਖੁਸ਼ ਹੁੰਦੇ ਲੈ ਵੀ ਜ਼ਮੀਨ 'ਚ ਪਾਣੀ ਜਾ ਰਿਹਾ ਇੱਦਾਂ ਹੀ ਪਾਣੀ ਖਾਣ ਦੀ ਤਰ੍ਹਾਂ ਤੁਸੀਂ ਪੀਓ ਉਹ ਜ਼ਿਆਦਾ ਲਾਹੇਵੰਦ ਹੈ ਪਾਣੀ ਦਿਨ ਦੇ ਵਿੱਚ ਬਹੁਤ ਲੋੜੀਂਦਾ ਹੈ ਪੀਣਾ ਚਾਹੀਦਾ ਹੈ